ਹਾਂ ਮੈਂ ਬਹੁਤ ਸਾਰੀਆਂ ਖੇਡਾਂ ਖੇਡੀਆਂ ਹਨ ਹਰੇਕ ਖੇਡ ਦੇ ਆਪਣੇ ਨਿਯਮ ਹੁੰਦੇ ਹਨ ਨਿਯਮਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੈ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ 'ਤੇ ਦੰਡ ਵੀ ਦਿੱਤਾ ਜਾਂਦਾ ਹੈ ਖੇਡ ਖੇਡਣ ਤੋਂ ਪਹਿਲਾਂ ਨਿਯਮ ਦੱਸੇ ਜਾਂਦੇ ਹਨ ਸਭ ਤੋਂ ਪਹਿਲਾਂ ਨਿਯਮ ਏ ਇਹ ਹੈ ਕਿ ਖਿਡਾਰੀ ਦਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ ਕੋਈ ਕਿਸੇ ਪ੍ਰਕਾਰ ਦਾ ਨਸ਼ੇ ਦਾ ਪ੍ਰਯੋਗ ਨਹੀਂ ਕਰਦਾ ਹੋਵੇ ਇਸ ਲਈ ਮੈਡੀਕਲ ਟੈਸਟ ਕਰਵਾਏ ਜਾਂਦੇ ਹਨ ਮੇਰੀ ਮਨਪਸੰਦ ਖੇਡ ਕ੍ਰਿਕਟ ਹੈ ਕ੍ਰਿਕਟ ਵਿੱਚ ਇੱਕ ਟੀਮ ਦੇ ਗਿਆਰਾਂ ਖਿਡਾਰੀ ਹੁੰਦੇ ਹਨ ਇੱਕ ਅੰਪਾਇਰ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪੂਰਾ ਧਿਆਨ ਰੱਖਦਾ ਹੈ ਇਸ ਖੇਡ ਇਸ ਖੇਡ ਗੇਂਦ ਨੂੰ ਸੁੱਟਣ ਵਾਸਤੇ ਇੱਕ ਲਕੀਰ ਖਿੱਚੀ ਜਾਂਦੀ ਹੈ ਇਸ ਤੋਂ ਅੱਗੇ ਗੇਂਦ ਕਰਵਾਉਣ ਵਾਲੇ ਦਾ ਪੈਰ ਨਹੀਂ ਜਾਣਾ ਚਾਹੀਦਾ ਇਸ ਪ੍ਰਕਾਰ ਬਾਹਰ ਦੀ ਬਾਊਂਡਰੀ ਤੋਂ ਗੇਂਦ ਬਾਹਰ ਜਾਣ 'ਤੇ ਨੰਬਰ ਦਿੱਤੇ ਜਾਂਦੇ ਹਨ ਇਸ ਖੇਡ ਵਿੱਚ ਖਿਡਾਰੀ ਵਿਰੋਧੀ ਖਿਡਾਰੀ ਨੂੰ ਗਲਤ ਗੱਲਬਾਤ ਨਹੀਂ ਕਰ ਸਕਦਾ ਇਸ ਖੇਡ ਵਿੱਚ ਕੈਚ ਆਊਟ ਰਨ ਆਊ ਆਉਣ 'ਤੇ ਐੱਲ ਬੀ ਡਬਲਯੂ ਆਊਟ ਹੁੰਦਾ ਹੈ ਇਸ ਤਰ੍ਹਾਂ ਹੋਰ ਵੀ ਕਈ ਨਿਯਮ ਬਣਾਏ ਗਏ ਹਨ ਖੇਡ ਖੇਡਣ ਤੋਂ ਪਹਿਲਾਂ ਸਾਰੇ ਖਿਡਾਰੀ ਇਕੱਠੇ ਹੋ ਕੇ ਖੇਡ ਦੀ ਤੌਰ ਤਰੀਕਿਆਂ ਦੀ ਗੱਲਬਾਤ ਕਰਦੇ ਹਨ ਕਿ ਕਿਵੇਂ ਅਸੀਂ ਇੱਕ ਦੂਸਰੇ ਨਾਲ ਖੇਡ ਵਿੱਚ ਗੱਲਬਾਤ ਕਰਨੀ ਹੈ